ਹੈਲੋ ਹਾਂਜੀ ਸਰ ਨਮਸਕਾਰ ਹਾਂਜੀ ਹਾਂਜੀ ਹਾਂਜੀ ਸਰ ਸਕੂਲ ਤਾਂ ਹਾਂਜੀ ਸਕੂਲ ਤਾਂ ਸਰ ਅਕਾਲ ਅਕੈਡਮੀ ਵੀ ਵਧੀਆ ਇਆ ਜਾਂ ਸਾਡੇ ਐਮ ਸੀ ਐਸ ਹੈ ਕਰਾਈਡੀਟਿੰਗ ਕੋਨਵੈਂਟ ਹੈ ਸਕੂਲ ਤਾਂ ਬਹੁਤ ਵਧੀਆ ਹੈ ਮੇਰੇ ਬੱਚੇ ਵੀ ਖੁਦ ਕਰਾਈਡੀਟਿੰਗ ਕੋਨਵੈਂਟ ਸਕੂਲ ਜਾਂਦੇ ਹੈ ਔਰ ਉੱਥੇ ਦੀ ਪੜ੍ਹਾਈ ਬਹੁਤ ਵਧੀਆ ਇਆ ਅਤੇ ਫੀਸ ਤਾਂ ਵੈਸੇ ਉੱਥੇ ਦਸ ਹਜ਼ਾਰ ਹੈ ਪਰ ਉਹਦੇ ਹਾਂਜੀ ਮਤਲਬ ਅਗਰ ਫੀਸ ਹੈ ਨਾ ਬਟ ਉੱਥੇ ਐਕਟੀਵਿਟੀਸ ਵੀ ਹੈ ਉਹ ਉਹਦੇ ਨਾਲ ਨਾਲ ਪੜ੍ਹਾਈ ਵੀ ਹੈ ਬਹੁਤ ਜ਼ਿਆਦਾ ਹਾਂਜੀ ਪਰ ਮੰਨਥ ਭੇਜ ਦਿਓ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਸਕੂਲੋਂ ਹੀ ਮਿਲ ਜਾਂਦੇ ਹੈ

ਫੋਰਮੈਲਟੀ ਉਹ ਆਪ ਹੀ ਦੱਸ ਦਿੰਦੇ ਹੁੰਦੇ ਹੈ ਹਾਂਜੀ ਓਕੇ ਓ